ਸਤਿ ਸ਼੍ਰੀ ਅਕਾਲ ਜੀ ਮੈਂ ਪਟਿਆਲਾ ਸ਼ਹਿਰ ਦੀ ਰਹਿਣ ਵਾਲੀ ਹਾਂ ਪਟਿਆਲਾ ਸ਼ਹਿਰ ਰਾਜੇ ਮਹਾਰਾਜਿਆਂ ਦਾ ਸ਼ਹਿਰ ਹੈ ਪਟਿਆਲਾ ਸ਼ਹਿਰ ਦੀ ਸਥਾਪਨਾ ਬਾਬਾ ਆਲਾ ਸਿੰਘ ਜੀ ਨੇ ਕੀਤੀ ਪਟਿਆਲਾ ਸ਼ਹਿਰ ਦੋ ਸ਼ਬਦ ਪੱਟੀ ਪਲੱਸ ਆਲਾ ਨੂੰ ਮਿਲਾ ਕੇ ਮੇਲ ਬਣਿਆ ਹੈ ਪਟਿਆਲਾ ਦੇ ਵਿੱਚ ਕਈ ਇਤਿਹਾਸਕ ਥਾਂਵਾਂ ਹਨ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਵੀ ਹੈ ਜਿੱਥੇ ਅਸੀਂ ਅਕਸਰ ਹੀ ਮੱਥਾ ਟੇਕਣ ਜਾਂਦੇ ਹਾਂ ਪਟਿਆਲਾ ਦੇ ਵਿੱਚ ਕਾਲੀ ਦੇਵੀ ਦਾ ਮੰਦਰ ਵੀ ਬਹੁਤ ਪ੍ਰਸਿੱਧ ਹੈ ਇੱਥੇ ਵੀ ਅਸੀਂ ਅਕਸਰ ਜਾਂਦੇ ਹਾਂ ਇੱਥੇ ਦੂਰੋਂ ਦੂਰੋਂ ਲੋਕੀ ਮੱਥਾ ਟੇਕਣ ਆਉਂਦੇ ਹਨ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਕੁਝ ਹੋਰ ਵੀ ਇਤਿਹਾਸਕ ਥਾਂਵਾਂ ਹਨ ਜਿਵੇਂ ਕਿ ਕਿਲਾ ਮੁਬਾਰਕ ਅਤੇ ਸ਼ੀਸ਼ ਮਹਿਲ ਪਟਿਆਲਾ ਦੇ ਵਿੱਚ ਸਰਕਾਰੀ ਮਹਿੰਦਰਾ ਕਾਲਜ ਦੀ ਵੀ ਆਪਣੀ ਹੀ ਇਤਿਹਾਸਕ ਮਹੱਤਤਾ ਹੈ ਇਸ ਦੀ ਸਥਾਪਨਾ ਮਹਾਰਾਜਾ ਮਹਿੰਦਰ ਸਿੰਘ ਨੇ ਅਠਾਰਾਂ ਸੌ ਪੰਝੱਤਰ ਈਸਵੀ ਦੇ ਵਿੱਚ ਕੀਤੀ ਪਟਿਆਲਾ ਸ਼ਹਿਰ ਬਹੁਤ ਹੀ ਖੂਬਸੂਰਤ ਹੈ ਮੈਨੂੰ ਮਾਣ ਹੈ ਕਿ ਮੈਂ ਇਸ ਸ਼ਹਿਰ ਦੀ ਵਸਨੀਕ ਹਾਂ ਧੰਨਵਾਦ ਜੀ